ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਡਾ ਨੰਬਰ ਓਲਾ ਐਪ ਤੋਂ ਲਿਆ ਸੀ ਮੈਂ ਪੁਰਾਣੀ ਬਾਰਾਂਦਰੀ ਪਟਿਆਲਾ ਗਲੀ ਨੰਬਰ ਬਾਰ੍ਹਾਂ ਵਿੱਚ ਰਹਿੰਦਾ ਹਾਂ ਅਸੀਂ ਸਾਰੇ ਇੱਕ ਅਪ੍ਰੈਲ ਨੂੰ ਤੁਹਾਡੀ ਆਟੋ ਰਿਸ਼ਕਾ ਬੁੱਕ ਕਰਨਾ ਚਾਹੁੰਦੇ ਹਾਂ ਅਸੀਂ ਬਾਰਾਂਦਰੀ ਤੋਂ ਸ਼ੀਸ਼ ਮਹਿਲ ਵੇਖਣ ਲਈ ਜਾਣਾ ਹੈ ਅਸੀਂ ਕੁੱਲ ਚਾਰ ਦੋਸਤ ਹਾਂ ਜਿਨ੍ਹਾਂ ਨੇ ਮਿਲ ਕੇ ਜਾਣਾ ਹੈ ਮੈਂ ਅਤੇ ਇੱਕ ਹੋਰ ਅਸੀਂ ਬਾਰਾਂਦਰੀ ਤੋਂ ਚੜ੍ਹਾਂਗੇ ਅਤੇ ਦੋ ਮੈਂਬਰ ਸਰਹੰਦੀ ਬਜ਼ਾਰ ਤੋਂ ਚੜ੍ਹਨਗੇ ਅਸੀਂ ਸਵੇਰੇ ਦਸ ਕੁ ਵਜੇ ਜਾਣਾ ਹੈ ਅਤੇ ਸਭ ਵੇਖ ਕੇ ਅਤੇ ਇਹ ਕੁਝ ਖਾ ਪੀ ਕੇ ਚਾਰ ਘੰਟਿਆਂ ਬਾਅਦ ਵਾਪਸ ਤੁਹਾਡੇ ਆਟੋ 'ਤੇ 'ਤੇ ਹੀ ਵਾਪਸ ਜਾਵਾਂਗੇ ਕਿਰਪਾ ਕਰਕੇ ਤੁਸੀਂ ਆਪਣੇ ਰੇਟਾਂ ਬਾਰੇ ਦੱਸੋ ਅਤੇ ਕੀ ਤੁਸੀਂ ਉਸ ਦਿਨ ਟਾਈਮ 'ਤੇ ਪਹੁੰਚ ਜਾਓਗੇ ਜੇਕਰ ਤੁਸੀਂ ਸੌ ਰੁਪਏ ਵਿੱਚ ਮੰਨ ਜਾਂਦੇ ਹੋ ਤਾਂ ਅਸੀਂ ਪੱਕਾ ਕਰਦੇ ਹਾਂ ਕਿ ਤੁਹਾਡੇ ਨਾਲ ਹੀ ਜਾਵਾਂਗੇ ਤੁਹਾਡਾ ਨੰਬਰ ਮੈਂ ਨੋਟ ਕਰ ਲਿਆ ਹੈ ਤੁਸੀਂ ਵੀ ਮੇਰਾ ਨੰਬਰ ਨੂੰ ਸੇਵ ਕਰ ਲਵੋ ਧੰਨਵਾਦ